ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਸੰਤ ਸਵੀਟ ਰੈਸਟੋਰੈਂਟ ਤੋਂ ਬੋਲ ਰਹੇ ਹੋ ਹਾਂਜੀ ਸਰ ਮੈਨੇ ਨਾ ਥੋੜ੍ਹੇ ਟਾਈਮ ਪਹਿਲਾਂ ਹੀ ਇੱਕ ਔ ਔਰਡਰ ਬੁੱਕ ਕੀਤਾ ਸੀ ਹਾਂਜੀ ਅੰਚਲ ਨਾਮ ਤੋਂ ਅਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਔਰਡਰ ਕਿਸੇ ਹੋਰ ਪਤੇ ਉੱਤੇ ਭੇਜ ਸਕਦੇ ਹੋ ਐਕਚੁਲੀ ਮੈਨੂੰ ਕੰਮ ਵਾਸਤੇ ਕਿਤੇ ਬਾਹਰ ਜਾਣਾ ਪੈ ਰਿਹਾ ਹੈਗਾ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਵੇਂ ਪਤੇ ਉੱਤੇ ਤੁਸੀਂ ਮੇਰਾ ਔਰਡਰ ਭੇਜੋ ਹਾਂਜੀ ਹਾਂਜੀ ਸਰ ਨੋਟ ਕਰੋ ਮੇਰਾ ਨਵਾਂ ਐਡਰੈਸ ਹੈ ਹਾਂਜੀ ਹਾਊਸ ਨੰਬਰ ਤਿੰਨ ਗਲੀ ਨੰਬਰ ਪੰਜ ਹਾਂਜੀ ਅਤੇ ਵਾਰਡ ਨੰਬਰ ਪੰਦਰ੍ਹਾਂ ਹਾਂਜੀ ਸਰ ਰਾਮ ਬਾਗ ਦੇ ਕੋਲ ਹਾਂਜੀ ਸਰ ਤੁਸੀਂ ਇੱਕ ਨੰਬਰ ਨੋਟ ਕਰੋ ਤੁਸੀਂ ਇਹਨਾਂ ਨੂੰ ਕਾਲ ਕਰਕੇ ਜੋ ਹੈ ਔਰਡਰ ਭੇਜ ਦਿਓ ਹਾਂਜੀ ਨੰਬਰ ਹੈ ਨੌ ਅੱਠ ਪੰਜ ਪੰਜ ਛੇ ਹਾਂਜੀ ਸੱਤ ਸਿਫਰ ਹਾਂਜੀ ਨੌ ਤਿੰਨ ਦੋ ਹਾਂਜੀ ਸਰ ਅਤੇ ਜਦੋਂ ਤੁਸੀਂ ਇਸ ਐਡਰੈਸ 'ਤੇ ਪਹੁੰਚ ਜਾਵੋਗੇ ਤਾਂ ਇਸ ਨੰਬਰ 'ਤੇ ਕੌਲ ਕਰਕੇ ਔਰਡਰ ਉੱਥੇ ਡਿਲੀਵਰ ਕਰ ਦਿਓ ਹਾਂਜੀ ਧੰਨਵਾਦ